ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਹਾਂਜੀ ਹਾਂਜੀ ਦੱਸੋ ਹਾਂਜੀ ਇੱਥੇ ਕਾਫੀ ਪੰਜਾਬੀ ਸੂਟ ਅਤੇ ਪੰਜਾਬੀ ਜੁੱਤੀਆਂ ਫੇਮਸ ਹੈਗੀਆਂ ਕਾਫ਼ੀ ਜਗ੍ਹਾ ਤੋਂ ਮਿਲ ਜਾਂਦੀ ਆ ਪਰ ਜੇ ਤੁਸੀਂ ਇੱਥੇ ਹੀ ਅਤੇ ਜਿਹੜੇ ਮਸ਼ਹੂਰ ਦੁਕਾਨਾਂ ਉਹ ਗੋਲਡਨ ਟੈਂਪਲ ਲਾਗੇ ਹੈਗੀ ਹੈ ਕਟਰਾ ਜੈਮਲ ਸਿੰਘ ਮਾਈ ਸੇਵਾ ਦੇ ਬਜ਼ਾਰ ਗੁਰੂ ਬਜ਼ਾਰ ਜਿੱਥੇ ਤੁਸੀਂ ਜਾ ਕੇ ਲੇ ਲਉ ਵਾਧੂ ਵਧੀਆ ਸੂਟ ਮਿਲ ਜਾਣਗੇ ਤੁਹਾਨੂੰ ਪੰਜਾਬੀ ਸਟਿੱਚ ਅਣਸਟਿੱਚ ਦੋਵੇਂ ਮਿਲ ਜਾਣਗੇ ਵ ਕਾਫ਼ੀ ਵਧੀਆ ਕੁਆਲਿਟੀ ਤਾਂ ਅਤੇ ਜੇ ਲੋੜ ਪਈ ਤਾਂ ਮੈਨੂੰ ਨਾਲ ਲੈ ਜਾਇਓ ਮੈਂ ਤੁਹਾਡੀ ਹੈਲਪ ਕਰ ਦੂੰਗੀ ਤੁਹਾਨੂੰ ਲੋਕੇਸ਼ਨ ਦੱਸ ਦੂੰਗੀ ਔਨਲਾਈਨ ਸੈਂਡ ਕਰ ਦੂੰਗੀ ਅੱਛਾ ਠੀਕ ਆ ਹਾਂਜੀ ਓਕੇ